ਮੈਨੂੰ ਬਾਹਰ ਦੇ ਢਾਬਿਆਂ ਅਤੇ ਹੋਟਲ ਦਾ ਖਾਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਿਵੇਂ ਕਿ ਆਪਾਂ ਢਾਬਿਆਂ ਤੋਂ ਰੋਟੀ ਸਬਜ਼ੀ ਵਗੈਰਾ ਆਰਡਰ ਕਰ ਸਕਦੇ ਹਾਂ ਅਤੇ ਉਹ ਬਹੁਤ ਹੀ ਵਧੀਆ ਹੁੰਦੀ ਹੈ ਅਤੇ ਉਸ ਤੋਂ ਇਲਾਵਾ ਕਿਸੇ ਹੋਟਲ ਚੋਂ ਕੁਛ ਮੰਗਵਾਉਂਦੇ ਹਾਂ ਕੁਛ ਖਾਂਦੇ ਹਾਂ ਜਿਵੇਂ ਬਰਗਰ ਪੀਜ਼ਾ ਨੂਡਲਜ਼ ਸੈਂਡਵਿਚ ਵਗੈਰਾ ਬਹੁਤ ਵਧੀਆ ਲੱਗਦਾ ਹੈ